ਸਾਨੂੰ ਲੱਗਦਾ ਹੈ ਕਿ ਵੱਡੀਆਂ ਸੰਸਥਾਵਾਂ ਜਿਵੇਂ ਕਿ ਆਈ ਆਈ ਟੀ ਆਈ ਆਈ ਐੱਸ ਸੀ ਅਤੇ ਆਈ ਆਈ ਐੱਮ ਸਭ ਲਈ ਕਿਫਾਇਤੀ ਹਨ ਇਸ ਖੇਤਰ ਵਿੱਚ ਮੁਕਾਬਲੇ ਅਤੇ ਵਿਦਿਆਰਥੀ ਦਵਾ ਬਾਰੇ ਅਸੀਂ ਇਹ ਸੋਚਦੇ ਹਨ ਕਿ ਇਹ ਜਿਹੜੇ ਕੋਂਪੀਟੀਸ਼ਨ ਹੁੰਦੇ ਹਨ ਇਹ ਬੜੇ ਟਫ ਹੁੰਦੇ ਹਨ ਅਤੇ ਇ ਇਸ ਲਈ ਬੱਚੇ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਕਿ ਇਸ ਵਿੱਚ ਬੱਚੇ ਨੂੰ ਕਾਫੀ ਜ਼ਿਆਦਾ ਕੋਚਿੰਗ ਲੈਣੀ ਪੈਂਦੀ ਹੈ ਅਤੇ ਦਿਨ ਰਾਤ ਮਤਲਬ ਹਾਰਡ ਵਰਕਿੰਗ ਵੀ ਕਰਨੀ ਪੈਂਦੀ ਹੈ ਅਤੇ ਇਹਨਾਂ ਕੋਚਿੰਗ ਸੈਂਟਰਾਂ ਦੀ ਫੀਸ ਵੀ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਇਸ ਬਾਰੇ ਅਸੀਂ ਇਹੀ ਸੋਚਦੇ ਹਨ ਕਿ ਇਹ ਕੋਚਿੰਗ ਸੈਂਟਰ ਜਿਹੜੇ ਵੀ ਨੇ ਇਹਨਾਂ ਦੀ ਫੀਸ ਘੱਟ ਕਰ ਦਿੱਤੀ ਜਾਵੇ ਤਾਂ ਕਿ ਹਰ ਵਰਗ ਦਾ ਬੱਚਾ ਇਸ ਕੋਂਪੀਟੀਸ਼ਨ ਵਿੱਚ ਹਿੱਸਾ ਲੈ ਸਕ ਸਕੇ ਅਤੇ ਇਸ ਵਿੱਚ ਐਡਮਿਸ਼ਨ ਲੈ ਸਕੇ ਤਾਂ ਕਿ ਉਹਦਾ ਭ ਭਵਿੱਖ ਸੁਰੱਖਸ਼ਿਤ ਹੋ ਸਕੇ